ਪੰਜਾਬ ਵਿੱਚ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਲਈ ਨਸ਼ਿਆਂ ਦਾ ਪ੍ਰਭਾਵ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਜਿਸ ਕਾਰਨ ਅੱਜ ਦੇ ਅੱਧ ਤੋਂ ਜ਼ਿਆਦਾ ਯੂਥ ਨਸ਼ਿਆਂ ਵੱਲ ਜਾ ਚੁੱਕਾ ਹੈ ਇਹਦਾ ਕਾਰਨ ਹੈ ਸਾਡੇ ਅਤੇ ਜਿੱਥੇ ਜ਼ਿਆਦਾ ਖੇਤਰਾਂ ਵਿੱਚ ਜ਼ਿਆਦਾ ਪੈਸਾ ਹੈ ਜਿੱਦਾਂ ਕਿ ਮੰਨ ਕੇ ਜਾ ਸਕਦੇ ਅਮਰੀਕਾ ਕਨੇਡਾ ਪੰਜਾਬ ਵਿੱਚ ਜਿਹੜੇ ਜਿਹੜੇ ਖੇਤਰ ਵਿੱਚ ਜ਼ਿਆਦਾ ਪੈਸਾ ਹੈ ਚੰਡੀਗੜ੍ਹ ਵੱਲ ਜ਼ਿਆਦਾ ਲੋਕ ਜ਼ਿਆਦਾ ਜਿਹਨਾਂ ਕੋਲ ਪੈਸਾ ਹੈ ਉਹ ਜ਼ਿਆਦਾ ਮਹਿੰਗੇ ਮਹਿੰਗੇ ਨਸ਼ੇ ਕਰ ਰਹੇ ਹਨ ਜਿੱਦਾਂ ਚਿੱਟਾ ਟੀਕੇ ਕੁਕੀਨ ਫੀਮ ਜਿਹਨਾਂ ਕੋਲ ਪੈਸਾ ਘੱਟ ਹੈ ਉਹ ਕੁਲੀਪ ਬੀੜੀ ਜਰਦਾ ਦਾਰੂ ਜਾਂ ਕਈ ਤਾਂ ਇੰਨਾਂ ਇੰਨਾਂ ਬੁਰਾ ਹਾਲ ਹੋ ਚੁੱਕਾ ਹੈ ਉਹ ਵੈਸਲੀਨ ਖਾਈ ਜਾ ਰਹੇ ਹਨ ਗੋਲੀਆਂ ਖਾ ਖਾ ਕੇ ਆਪਣਾ ਟਾਈਮ ਕੱਢ ਰਹੇ ਹਨ ਇਹਨਾਂ ਦਾ ਇਹਨੂੰ ਰੋਕਣ ਲਈ ਸਰਕਾਰ ਨੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਅਭਿਆਨ ਸਕੀਮਾਂ ਵੀ ਚਲਾਈਆਂ ਪਰ ਇਹ ਬੇਰੁਜ਼ਗਾਰੀ ਕਾਰਨ ਹੀ ਜ਼ਿਆਦਾਤਰ ਲੋਕ ਨਸ਼ਿਆਂ ਵੱਲ ਜਾ ਜੁ ਰਹੇ ਹਨ ਗਰੀਬੀ ਬਹੁਤ ਵੱਡਾ ਕਾਰਨ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਜੋ ਸ ਯੂਥਾਂ ਨੂੰ ਕੋਈ ਜ਼ਿਆਦਾ ਨੌਕ ਨੌਕਰੀ ਨਹੀਂ ਮਿਲ ਰਹੀਆਂ ਜਿਸ ਕਾਰਨ ਉਹ ਕੋਮਪੈਟ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ ਇਸੇ ਕਾਰਨ ਉਹ ਜ਼ਿਆਦਾ ਤੋਂ ਜ਼ਿਆਦਾ ਨਸ਼ਿਆਂ ਵੱਲ ਜਾ ਰੁਝਾਨ ਹੋ ਰਿਹਾ ਹੈ ਇਹ ਯੂਥ ਜ਼ਿਆਦਾਤਰ ਕੋਲਜ ਸਕੂਲ ਸੈਕਟਰਾਂ ਵਿੱਚ ਹੀ ਜ਼ਿਆਦਾ ਵਿਗੜ ਜਾਂਦਾ ਹੈ ਜਾਂ ਮਾੜੀ ਸੰਗਤ ਉਹਨਾਂ ਨੂੰ ਮਿਲ ਕੇ ਵਿਗਾੜਦੀ ਹੈ ਇਸ ਕਾਰਨ ਓਡ ਉਹਨਾਂ ਦੀ ਗੱਲਾਂ 'ਚ ਆ ਕੇ ਵੀ ਜ਼ਿਆਦਾਤਰ ਲੋਕ ਨਸ਼ਿਆਂ ਵੱਲ ਰੁਝਾਨ ਜਾ ਰਿਹਾ ਹੈ ਇਸੇ ਲਈ ਸਾਡੇ ਸਾਡੀ ਸਰਕਾਰ ਨੇ ਇਹ ਰੋਕਣ ਲਈ ਨਸ਼ਾ ਛਡਾਉ ਕੇਂਦਰ ਵੀ ਖੋਲ੍ਹੇ ਜਾ ਰਹੇ ਹਨ ਤੇ ਇਹਨਾਂ ਨੇ ਕਈ ਅਭਿਆਨ ਕੈਂਪ ਯੋਜਨਾ ਵੀ ਚਲਾਈਆਂ ਜਾ ਰਹੀਆਂ ਹਨ ਇਹ ਪਿੰਡਾਂ ਪਿੰਡਾਂ ਜਾ ਕੇ ਬੱਚਿਆਂ ਨੂੰ ਪ੍ਰੇਰਿਤ ਕਰ ਰਹੀਆਂ ਹਨ ਕਿ ਸਪੋਰਟਸ ਵੱਲ ਧਿਆਨ ਕਰੋ ਇਹ ਨਸ਼ੇ ਮੁੁਕਤ ਪੰਜਾਬ ਬਣਾਓ ਇਸ ਸਾਡੀ ਸਰਕਾਰਾਂ ਨੇ ਬਹੁਤ ਜ਼ਿਆਦਾ ਹੱਦ ਤੱਕ ਪਾਬੰਦੀ ਚਿੱਟਾ ਨਸ਼ਿਆਂ ਨੂੰ ਰੋਕ ਦਿੱਤਾ ਹੈ ਇਸ ਲਈ ਸਾਨੂੰ ਆਪਣੀ ਸਰਕਾਰ ਵੱਲੋਂ ਬਹੁਤ ਜ਼ਿਆਦਾ ਵਧੀਆ ਕੰਮ ਕੀਤਾ ਜਾ ਰਿਹਾ ਹੈ